ਜਿਵੇਂ ਕਿ ਸਾਡੇ ਪੰਜਾਬ ਦੇ ਲੋਕ ਨਾਚ ਨੇ ਜਿਵੇਂ ਕਿ ਭੰਗੜਾ ਹੋ ਗਿਆ ਅਤੇ ਗਿੱਧਾ ਹੋ ਗਿਆ ਅਤੇ ਮੈਂ ਇਹਨਾਂ ਨੂੰ ਸਹੀ ਬਾਹਰਲੇ ਦੇਸ਼ਾਂ ਤੱਕ ਪਹੁੰਚਾਉਣਾ ਚਾਹੁੰਦਾ ਏ ਕਿਉਂਕਿ ਜਿਵੇਂ ਕਿ ਭੰਗੜਾ ਪਾਉਣ ਦੇ ਨਾਲ ਸਰੀਰ ਬਹੁਤ ਫਿੱਟ ਰਹਿੰਦਾ ਏ ਅਤੇ ਬਹੁਤ ਫਿੱਟ ਰਹਿੰਦਾ ਹੈ ਅਤੇ ਸਰੀਰ ਦੇ ਵਿੱਚ ਪੂਰੀ ਉਹ ਫਿਟਿੰਗ ਆ ਜਾਂਦੀ ਹੈ ਭੰਗੜੇ ਦੇ ਨਾਲ ਜਿਵੇਂ ਕਿ ਸਾਨੂੰ ਇਹ ਜ਼ਿਆਦਾ ਤੌਰ 'ਤੇ ਖੁਸ਼ੀ ਦੇ ਮੌਕਿਆਂ 'ਤੇ ਹੀ ਪਾਏ ਜਾਂਦੇ ਨੇ ਤਾਂ ਕਿ ਇਹ ਜਿਵੇਂ ਕਿ ਵਿਆਹ ਸ਼ਾਦੀਆਂ ਦੇ ਵਿੱਚ ਭੰਗੜੇ ਅਤੇ ਹੋਰ ਕੋਈ ਜਿਵੇਂ ਕੋਈ ਕਿਸੇ ਦੇ ਲੋਹੜੀ ਹੁੰਦੀ ਹੈ ਉਹਨਾਂ ਦੇ ਵਿੱਚ ਭੰ ਭੰਗੜਾ ਪਾਇਆ ਜਾਂਦਾ ਹੈ ਜਿਵੇਂ ਕਿ ਲੋਹੜੀ ਹੋ ਗਈ ਹੋਰ ਖੁਸ਼ੀਆਂ ਜਿੰਨੀਆਂ ਵੀ ਹੁੰਦੀਆਂ ਨੇ ਤਿਉਹਾਰ ਸਾਡੇ ਸਾਰੇ ਖੁਸ਼ੀਆਂ ਦੇ ਹੀ ਹੁੰਦੇ ਹਨ ਇਸ ਕਰਕੇ ਮੈਂ ਇਹਨਾਂ ਨੂੰ ਬਾਹਰਲੇ ਦੇਸ਼ਾਂ ਵਿੱਚ ਵੀ ਲੈ ਕੇ ਜਾ ਜਾਣ ਦੀ ਕੋਸ਼ਿਸ਼ ਕਰ ਰਿਹਾ ਹਾਂ